ਹੈਲੋ ਹਾਂਜੀ ਸਰ ਮੈਂ ਨਾ ਤੁਹਾਡੇ ਐਮੇਜੋਨ ਤੋਂ ਪ੍ਰੋਡਕਟ ਖਰੀਦਿਆ ਸੀ ਹਾਂਜੀ ਹਾਂਜੀ ਪਹੁੰਚ ਗਿਆ ਜੀ ਹਾਂਜੀ ਠੀਕ ਹਾਂਜੀ ਠੀਕ ਟਾਈਮ 'ਤੇ ਪਹੁੰਚਿਆ ਹਾਂਜੀ ਡਿਸਕਾਊਂਟ ਵੀ ਸਹੀ ਮਿਲਿਆ ਹਾਂਜੀ ਪ੍ਰੋਡਕਟ ਠੀਕ ਹੈ ਜੀ ਕੁਆਲਿਟੀ ਠੀਕ ਲੱਗ ਰਹੀ ਹੈ ਪਰ ਸਰ ਮੈਂ ਤੁਹਾਨੂੰ ਇੱਕ ਤੁਹਾਡਾ ਜਿਹੜਾ ਡਿਲੀਵਰੀ ਬੋਆਏ ਆ ਨਾ ਉਹਦੇ ਬਾਰੇ ਥੋੜ੍ਹਾ ਕੁਝ ਕਹਿਣਾ ਚਾਹੁੰਦੀ ਹਾਂ ਮਤਲਬ ਕਿ ਉਹ ਮੈਨੂੰ ਸਹੀ ਨਹੀਂ ਲੱਗਿਆ ਹੈ ਨਾ ਮੈਂ ਘਰ ਇਕੱਲੀ ਸੀ ਅਤੇ ਉਸਨੇ ਨਾ ਤਾਂ ਵੈੱਲ ਕੀਤੀ ਹੈ ਘਰ ਦੇ ਦਰਵਾਜ਼ੇ ਦੀ ਨਾ ਮਤਲਬ ਕਿ ਉਸਨੇ ਵੇਟ ਕੀਤੀ ਹੈ ਹੈ ਨਾ ਉਹ ਉਸਨੇ ਆਪਣੇ ਮਤਲਬ ਕਿ ਹੋਰਨ ਮਾਰਨਾ ਸ਼ੁਰੂ ਕਰ ਦਿੱਤਾ ਔਰ ਜਦ ਮੈਂ ਘਰ ਦਰਵਾਜ਼ੇ ਤੋਂ ਬਾਹਰ ਆਈ ਤਾਂ ਉਸਦਾ ਮੈਨੂੰ ਬਿਹੇਵੀਅਰ ਵੀ ਕੋਈ ਜ਼ਿਆਦਾ ਚੰਗਾ ਨਹੀਂ ਲੱਗਿਆ ਜਿਸ ਤਰ੍ਹਾਂ ਉਹ ਗੱਲ ਕਰ ਰਿਹਾ ਸੀ ਨਾ ਮਤਲਬ ਕਿ ਜਿਵੇਂ ਤੁਹਾਡੀ ਕੰਪਨੀ ਦਾ ਬਹੁਤ ਵਧੀਆ ਕੰਪਨੀ ਹੈ ਹੈ ਨਾ ਮਤਲਬ ਕਿ ਤੁਹਾਡੇ ਇੰਪਲੋਇਰ ਵੀ ਵਧੀਆ ਹੀ ਹੋਣਗੇ ਮਤਲਬ ਕਿ ਓਦਾਂ ਉਸਦੀ ਮਤਲਬ ਕਿ ਲੁੱਕ ਮੈਨੂੰ ਕੋਈ ਲੱਗੀ ਨਹੀਂ ਲੈਗੂਏਜ ਵੀ ਕੋਈਉਹਦੀ ਵ ਵਧੀਆ ਨਹੀਂ ਸੀ ਮਤਲਬ ਕਿ ਇੱਕ ਇਕੱਲੀ ਲੇਡੀ ਘਰ ਹੈ ਉਹਦੇ ਨਾਲ ਕਿਵੇਂ ਗੱਲ ਕਰਨੀ ਹੈ ਘਰ ਜਾ ਕੇ ਕਿਵੇਂ ਦਰਵਾਜ਼ਾ ਖੜਕਾਉਣਾ ਐਵੇਂ ਉਹਦਾ ਮੈਨੂੰ ਬਿਹੇਵੀਅਰ ਵਧੀਆ ਨਹੀਂ ਲੱਗਿਆ ਸਰ ਹਾਂਜੀ ਨਹੀਂ ਬਾਕੀ ਤਾਂ ਸਰ ਠੀਕ ਹੈ ਵੀ ਮਤਲਬ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਵੀ ਤੁਹਾਡੀ ਕੰਪਨੀ ਬਹੁਤ ਵਧੀਆ ਤੁਹਾਡੇ ਪ੍ਰੋਡਕਟ ਮੇਰਾ ਬੇਟਾ ਛੋਟਾ ਸੀ ਉਹਦੇ ਕੱਪੜਿਆਂ ਤੋਂ ਲੈ ਕੇ ਟੋਏਜ਼ ਵਗੈਰਾ ਸਭ ਕੁਝ ਖਰੀਦਦੇ ਰਹਿੰਦੇ ਹਾਂ ਐਮੇਜੋਨ ਤੋਂ ਹੀ ਲੈਂਦੇ ਹਾਂ ਜ਼ਿਆਦਾਤਰ ਸਾਨੂੰ ਸਭ ਕੁਛ ਵਧੀਆ ਲੱਗਿਆ ਪਰ ਸਰ ਇਹਦੀ ਤੁਹਾਨੂੰ ਜਿਹੜੀ ਡਿਲੀਵਰੀ ਬੋਏ ਦਾ ਬਿਹੇਵੀਅਰ ਸਾਨੂੰ ਨਹੀਂ ਵਧੀਆ ਲੱਗਿਆ ਹਾਂ ਸਰ ਤੁਸੀਂ ਮਤਲਬ ਕਿ ਦੇਖੋ ਥੋੜ੍ਹਾ ਕਰੋ ਵੀ ਆਪਣੇ ਜਿਹੜੇ ਡਿਲੀਵਰੀ ਬੋਏ ਨੇ ਮਤਲਬ ਕਿ ਕਿਵੇਂ ਘਰ ਜਾਣਾ ਕਿਵੇਂ ਡੀਲਿੰਗ ਉਹਨਾਂ ਦੀ ਹੋਰ ਵਧੀਆ ਹੋਵੇ ਇਸ ਲਈ ਮੈਂ ਤੁਹਾਨੂੰ ਇਸ ਬਾਰੇ ਦੱਸਣਾ ਚਾਹੁੰਦੀ ਹਾਂ ਸਰ ਹਾਂਜੀ ਹਾਂਜੀ ਬਾਕੀ ਸਰ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਸਰ ਪਹਿਲਾਂ ਵੀ ਤੁਹਾਡੇ ਪ੍ਰੋਡਕਟ ਮੈਨੂੰ ਬਹੁਤ ਅੱਛੇ ਲੱਗੇ ਹਾਂਜੀ ਠੀਕ ਹੈ ਸਰ ਓਕੇ ਥੈਂਕ ਯੂ ਸਰ